ਹੈਲੋ ਭਰਾਵਾਂ ਦੇ ਢਾਬੇ ਤੋਂ ਸੰਦੀਪ ਜੀ ਗੱਲ ਕਰ ਰਹੇ ਨੇ ਹਾਂਜੀ ਸੰਦੀਪ ਜੀ ਮੈਂ ਆਪ ਜੀ ਦਾ ਆਪ ਜੀ ਨੂੰ ਆਡਰ ਦਿੱਤਾ ਸੀ ਚਾਵਲ ਸੂਪ ਪਰਾਂਠੀ ਦਾਲ ਪਨੀਰ ਅਤੇ ਮਿਕਸ ਵੈਜ ਦਾ ਦਿੱਤਾ ਸੀ ਤੁਹਾਨੂੰ ਆਡਰ ਪਰ ਉਹ ਉਹ ਉਹਦੇ ਵਿੱਚ ਕੁਛ ਚੀਜ਼ ਇੱਕ ਇੱਕ ਚੀਜ਼ ਭੁੱਲ ਗਿਆ ਹਾਂ ਕਿ ਕਿਰਪਾ ਕਰਕੇ ਉਸਨੂੰ ਐਡ ਕਰ ਦਿੱਤਾ ਜਾਵੇ ਮੈਨੂੰ ਇੱਕ ਸੈਲਡ ਦੀ ਪਲੇਟ ਵੀ ਨਾਲ ਦੇ ਦਿੱਤੀ ਜਾਵੇ ਜਿਸ ਵਿੱਚ ਮੂਲੀ ਗਾਜਰ ਟਮਾਟਰ ਪਿਆਜ਼ ਅਤੇ ਚੁਕੰਦਰ ਦਾ ਸਲਾਦ ਬ ਬੜਾ ਜ਼ਰੂਰੀ ਹੈ ਇਹ ਸਲਾਦ ਨਾਲ ਮੇਰੇ ਐਸੀਡਿਟੀ ਅਤੇ ਹੋਰ ਕਈ ਤਰ੍ਹਾਂ ਦੀਆਂ ਪ੍ਰੋਬਲਮ ਸਹੀ ਹੋ ਜਾਂਦੀਆਂ ਹਨ ਕਿਉਂਕਿ ਰਾ ਇਹ ਇਹ ਰਾਤ ਦਾ ਖਾਣਾ ਖਾ ਰਿਹਾ ਹਾਂ ਇਹ ਇਹਦੇ ਨਾਲ ਮੈਨੂੰ ਸੈਲਡ ਦਾ ਬਹੁਤ ਨਾਲ ਹੋਣਾ ਬਹੁਤ ਜ਼ਰੂਰੀ ਹੈ ਕਿਰਪਾ ਕਰਕੇ ਤੁਹਾਡੀ ਆਹ ਵੀ ਚੀਜ਼ਾਂ ਬਹੁਤ ਵਧੀਆ ਵਾ ਪਨੀਰ ਵੀ ਬਹੁਤ ਵਧੀਆ ਵੈਸੇ ਇਹ ਸੂਪ ਵੀ ਬਹੁਤ ਚੰਗਾ ਵਾ ਪਰਾਂਠੀ ਵੀ ਚੰਗੀ ਆ ਅਤੇ ਚਾਵਲ ਤੁਹਾਡੇ ਬਹੁਤ ਵਧੀਆ ਮੈਨੂੰ ਲੱਗਦੇ ਹਨ ਜਿਹੜੇ ਬਾਸਮਤੀ ਤੁਸੀਂ ਚਾਵਲ ਲਿਆਉਂਦੇ ਹਨ ਕਿਰਪਾ ਕਰਕੇ ਆਹ ਚੀਜ਼ ਮੈਨੂੰ ਜ਼ਰੂਰ ਨਾਲ ਐਡ ਕਰ ਦਿੱਤੀ ਜਾਵੇ ਤਾਂ ਜੋ ਮੇਰੀ ਜਿਹੜੀ ਡਾਇਟ ਵਧੀਆ ਅਤੇ ਮ ਸਿਹਤਮੰਦ ਡਾਇਟ ਮੈਂ ਖਾ ਸਕਾਂ